ਮੁੱਢ ਤੋਂ ਹੀ ਲੋਕ ਵਹਿਮਾ ਭਰਮਾਂ ਦੇ ਵਿੱਚ ਵਿਸ਼ਵਾਸ ਕਰਦੇ ਆ ਰਹੇ ਹਨ ਇਹ ਵਹਿਮ ਭਰਮ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੇ ਹੋਏ ਹਨ ਬਹੁਤ ਸਾਰੇ ਲੋਕ ਦਿਨ ਦੇਖ ਕੇ ਵਿਚਾਰ ਕਰਦੇ ਹਨ ਕਿ ਅੱਜ ਇਹ ਕੰਮ ਕਰਨਾ ਹੈ ਜਾਂ ਨਹੀਂ ਜਿਵੇਂ ਕਿ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਸਿਰ ਨਹੀਂ ਧੋਣਾ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਨਹੁੰ ਨਹੀਂ ਕੱਟਣੇ ਸ਼ਨੀਵਾਰ ਨੂੰ ਕੋਈ ਕਾਲੀ ਚੀਜ਼ ਨਹੀਂ ਖਰੀਦਣੀ ਜਾਂ ਕੋਈ ਲੋਹੇ ਦੀ ਚੀਜ਼ ਨਹੀਂ ਖਰੀਦਣੀ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਅੰਕਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਕਿਹੜਾ ਅੰਕ ਉਹਨਾਂ ਦੇ ਲਈ ਸ਼ੁਭ ਹੈ ਜਾਂ ਅਸ਼ੁਭ ਹੈ ਅੰਕਾਂ ਦੇ ਹਿਸਾਬ ਦੇ ਨਾਲ ਹੀ ਲੋਕ ਆਪਣੇ ਸਕੂਟਰਾਂ ਜਾਂ ਗੱਡੀਆਂ ਦੇ ਨੰਬਰ ਲੈਂਦੇ ਹਨ ਜਾਂ ਫਿਰ ਤਰੀਕ ਦੇਖ ਕੇ ਕੋਈ ਕੰਮ ਕਰਦੇ ਜਾਂ ਸਮਾਨ ਖਰੀਦਦੇ ਹਨ ਬਹੁਤ ਸਾਰੇ ਵਹਿਮ ਭਰਮ ਅਜਿਹੇ ਹਨ ਜਿਨ੍ਹਾਂ ਕਰਕੇ ਕਈ ਵਾਰ ਕਿਸੇ ਬੰਦੇ ਨੂੰ ਬੁਰਾ ਵੀ ਬਣਾ ਦਿੱਤਾ ਜਾਂਦਾ ਹੈ ਜਿਵੇਂ ਕਿ ਇਸ ਬੰਦੇ ਦੀ ਬੁਰੀ ਨਜ਼ਰ ਲੱਗਦੀ ਹੈ ਬਹੁਤ ਸਾਰੇ ਵਹਿਮ ਭਰਮ ਬੱਚਿਆਂ ਦੇ ਬੁਰੀ ਨਜ਼ਰ ਦੇ ਨਾਲ ਵੀ ਜੁੜੇ ਹੋਏ ਹਨ ਕਈ ਵਹਿਮ ਭਰਮ ਅਜਿਹੇ ਹਨ ਜੋ ਕਿ ਵਿਆਹ ਸ਼ਾਦੀਆਂ ਦੌਰਾਨ ਵੀ ਕੀਤੇ ਜਾਂਦੇ ਹਨ ਵਿਆਹ ਸ਼ਾਦੀਆਂ ਦੇ ਟਾਈਮ ਵਿੱਚ ਕਦ ਕਦੋਂ ਸ਼ੁੱਭ ਦਿਨ ਹੈ ਨਹੀਂ ਹੈ ਜਾਂ ਕਿਹੜਾ ਕੰਮ ਕਦੋਂ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਦਾ ਵਹਿਮ ਭਰਮਾਂ ਕਰਕੇ ਹੀ ਖਿਆਲ ਰੱਖਿਆ ਜਾਂਦਾ ਹੈ ਬਹੁਤ ਸਾਰੇ ਵਹਿਮ ਭਰਮ ਨੇ ਜੋ ਕੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਕਿਸੇ ਨੇ ਛਿੱਕ ਮਾਰ ਦਿੱਤੀ ਤਾਂ ਅੱਗੇ ਨਹੀਂ ਵੱਧਣਾ ਬਿੱਲੀ ਨੇ ਰਸਤਾ ਕੱਟ ਦਿੱਤਾ ਜਾਂ ਫਿਰ ਕਾਰਸੀ ਵਾਲੇ ਦਿਨ ਚਾਵਲ ਨਾ ਬਣਾਉਣਾ ਆਦਿ